ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਸੂਰਯ ਗ੍ਰਹਿ ਅਤੇ ਚੰਦਰ ਗ੍ਰਹਿਣ ਲੱਗਦੇ ਹਨ ਅਤੇ ਵੈਦਿਕ ਸ਼ਾਸਤਰਾਂ ਦੇ ਰਾਹੀਂ ਇਹਨਾਂ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਜਦ ਵੀ ਸੂਰਯ ਗ੍ਰਹਿਣ ਲੱਗਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਘਰੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਜਦ ਵੀ ਸੂਰਯ ਗ੍ਰਹਿਣ ਲੱਗਦਾ ਹੈ ਜਾਂ ਅਸੀਂ ਸੂਰਯ ਗ੍ਰਹਿ ਲੱਗਦੇ ਸਮੇਂ ਸੂਰਜ ਵੱਲ ਦੇਖਦੇ ਹਾਂ ਅਤੇ ਸਾਡੀ ਆਈਸਾਈਟ ਅੱਖਾਂ ਦੀ ਰੌਸ਼ਨੀ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ ਸੋ ਇਸ ਕਰਕੇ ਜਦ ਵੀ ਸੂਰਯ ਗ੍ਰਹਿਣ ਲੱਗੇ ਸਾਨੂੰ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਚੰਦਰ ਗ੍ਰਹਿਣ ਵਾਲੇ ਦਿਨ ਇਸ ਤਰ੍ਹਾਂ ਦੀ ਕੁਛ ਨਹੀਂ ਹੁੰਦਾ ਇਸ ਸਾਲ ਸਭ ਤੋਂ ਪਹਿਲਾਂ ਗ੍ਰਹਿਣ ਪੱਚੀ ਮਾਰਚ ਦੋ ਹਜ਼ਾਰ ਚੌਵੀ ਨੂੰ ਲੱਗਿਆ ਸੀ ਜਿਸ ਦਿਨ ਕਿ ਹੋਲੀ ਸੀ ਇਸ ਦਾ ਸਮਾਂ ਸਾਢੇ ਦਸ ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵੱਜ ਕੇ ਦੋ ਮਿਨਟ ਤੱਕ ਰਿਹਾ ਸੀ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਗ੍ਰਹਿ ਸੌ ਸਾਲ ਬਾਅਦ ਆਉਂਦਾ ਹੈ ਜਿਸ ਦਿਨ ਸੌ ਸਾਲ ਬਾਅਦ ਜਦ ਇਹ ਗ੍ਰਹਿ ਆਉਂਦਾ ਹੈ ਤਾਂ ਇਸ ਦਿਨ ਪੈਸੇ ਦੀ ਪ੍ਰਾਪਤੀ ਹੁੰਦੀ ਹੈ ਘਰ ਦੀ ਆਰਥਿਕ ਵਿਵਸਥਾ ਵੀ ਠੀਕ ਹੁੰਦੀ ਹੈ ਅਤੇ ਹੋਰ ਵੀ ਜੋ ਰੁਝੀਆਂ ਹੋਈਆਂ ਉਲਝੀਆਂ ਹੋਈਆਂ ਸਮੱਸਿਆ ਹਨ ਉਹ ਵੀ ਠੀਕ ਹੁੰਦੀਆਂ ਹਨ ਮੈਨੂੰ ਚੰਦਰ ਗ੍ਰਹਿਣ ਅਤੇ ਸੂਰਯ ਗ੍ਰਹਿਣ ਬਾਰੇ ਕੁਛ ਖਾਸ ਤਾਂ ਨਹੀਂ ਪਤਾ ਪਰ ਹਾਂ ਮੈਨੂੰ ਇਹਨਾਂ ਜ਼ਰੂਰ ਪਤਾ ਹੈ ਕਿ ਜਦ ਵੀ ਚੰਦਰ ਗ੍ਰਹਿਣ ਲੱਗਦਾ ਹੈ ਜਿਹੜਾ ਕਿ ਸੌ ਸਾਲ ਬਾਅਦ ਆਉਂਦਾ ਹੈ ਉਸ ਉਹ ਦਿਨ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਉਸ ਦਿਨ ਸਾਰੇ ਕੰਮ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਸਾਨੂੰ ਇਹਨਾਂ ਗ੍ਰਹਿਵਾਂ ਨੂੰ ਮੰਨਣਾ ਚਾਹੀਦਾ ਹੈ